ਹਾਂ ਸਾਡੇ ਪੇਂਡੂ ਖੇਤਰ ਵਿੱਚ ਵੀ ਅਜਿਹਾ ਕਾਰੋਬਾਰ ਸ਼ੁਰੂ ਹੋਇਆ ਹੈ ਜੋ ਸਾਡੇ ਵਿਰਾਸਤ ਨਾਲ ਮਿਲਿਆ ਜੁਲਿਆ ਹੈ ਇਹ ਸਾਡ ਇਸ ਕੰਮ ਬਾਰੇ ਅਸੀਂ ਪੂਰੇ ਜਾਣਕਾਰੀ ਦੇਵਾਂਗੇ ਇਸ ਕੰਮ ਨੂੰ ਅਸੀਂ ਘੁਮਿਆਰ ਨਾ ਦਿੰਦੇ ਹਾਂ ਇਸ ਵਿੱਚ ਮਿੱਟੀ ਦੇ ਲੋਕ ਬਰਤਨ ਬਣਾਉਂਦੇ ਹਨ ਇਸ ਮਿੱਟੀ ਦੇ ਬਰਤਨ ਇਸ ਤਰ੍ਹਾਂ ਬਣਾਏ ਜਾਂਦੇ ਡਿਜ਼ਾਇਨ ਕੀਤੇ ਜਾਂਦੇ ਹਨ ਕਿ ਇਹ ਬਰਤਨ ਨੂੰ ਲੋਕਾਂ ਦੇ ਮਨ ਵਿੱਚ ਦਿਲਚਸਪੀ ਕਰਨ ਇਹ ਇਹ ਬਰਤਨ ਸਾਡੇ ਸਿਹਤ ਲਈ ਅਤੇ ਸਾਡੇ ਪੁਰਾਣੇ ਵਿਰਾਸਤ ਲਈ ਵੀ ਵਧੀਆ ਹੈ ਇਸ ਵਿੱਚ ਅਸੀਂ ਪਾਣੀ ਦਾ ਘੜਾ ਲਾ ਲਓ ਅਤੇ ਕੁੱਜੇ ਗੱਲੇ ਵਗੈਰਾ ਸਭ ਇਸ ਵਿੱਚ ਸ਼ਾਮਲ ਹਨ ਇਹ ਮਿੱਟੀ ਦੇ ਬਰਤਨ ਅੱਜ ਦੇ ਸਮੇਂ ਵਿੱਚ ਬਹੁਤ ਜ਼ਿਆਦਾ ਚੱਲ ਰਹੇ ਹਨ ਮਿੱਟੀ ਦੇ ਬਰਤਨਾਂ ਦੀ ਬਹੁਤ ਜ਼ਿਆਦਾ ਖਾਸੀਅਤ ਹੁੰਦੀ ਹੈ ਮਿੱਟੀ ਦੇ ਬਰਤਨਾਂ ਵਿੱਚ ਬਹੁਤ ਜ਼ਿਆਦਾ ਗੁਣ ਹੁੰਦੇ ਹਨ ਅੱਜ ਕੱਲ੍ਹ ਤਾਂ ਮਿੱਟੀ ਦੇ ਬਰਤਨਾਂ ਨੂੰ ਹੱਦ ਤੋਂ ਵੱਧ ਲੋਕ ਜ਼ਿਆਦਾ ਘਰਾਂ ਵਿੱਚ ਵਰਤੋਂ ਕਰ ਰਹੇ ਹਨ ਅਤੇ ਨਵੀਆਂ ਆਉਣ ਵਾਲੀ ਤਕਨੀਕਾਂ ਨੂੰ ਮੁੜ ਵਾਪਸ ਕਰ ਰਹੇ ਹਨ ਮਿੱਟੀ ਦੇ ਬਰਤਨ ਬਹੁਤ ਜ਼ਿਆਦਾ ਲਾਭਦਾਇਕ ਹੁੰਦੇ ਹਨ ਇਸ ਲਈ ਅਸੀਂ ਮਿੱਟੀ ਦੇ ਬਰਤਨਾਂ ਦੀ ਵੱਧ ਤੋਂ ਵੱਧ ਵਰਤੋਂ ਕਰਨੀ ਚਾਹੀਦੀ ਹੈ